ਹਰ ਕੰਮ ਨੂੰ ਸ਼ੁਰੂ ਕਰਨ ਵਾਸਤੇ ਸਾਨੂੰ ਕੋਈ ਨਾ ਕੋਈ ਪੈਸੇ ਦੀ ਲੋੜ ਹੁੰਦੀ ਹੈ ਜੇ ਉਹ ਪੈਸਾ ਆਪਾਂ ਬੈਂਕ ਤੋਂ ਵੀ ਲੈ ਸਕਦੇ ਹਾਂ ਜਾਂ ਕਿਸੇ ਆਮ ਆਪਣੇ ਰਿਸ਼ਤੇਦਾਰ ਤੋਂ ਵੀ ਲੈ ਸਕਦਾ ਤੇ ਇਹਨੂੰ ਵਾ ਸਾਨ ਸਾਨੂੰ ਬਹੁਤ ਸਾਰੀ ਕਿਰਿਆਨ ਦਾ ਯੂਜ ਕੀਤਾ ਪੈਂਦਾ ਹੈ ਆਪਾਂ ਜਾ ਕੇ ਆਪਣਾ ਰਜਿਸਟਰ ਕਰਦੇ ਹਾਂ ਕੰਪਨੀ ਨੂੰ ਆਪਣੇ ਦਾਖਿਲਾ ਦਿੰਦੇ ਹਨ ਤੇ ਉਹਨੂੰ ਦਾਖਲਾ ਦੇਣ ਤੋਂ ਬਾਅਦ ਆਪਾਂ ਸਾਰੀ ਕਿਰਿਆ ਨੂੰ ਪੂਰਾ ਕਰਦੇ ਹਾਂ ਇਹ ਕਿਰਿਆ ਨੂੰ ਪੂਰਾ ਕਰਨ ਵਾਸਤੇ ਸਾਨੂੰ ਬਹੁਤ ਸਾਰੇ ਲੋਕਾਂ ਦੀ ਲੋੜ ਪੈਂਦੀ ਹੈ ਇਹ ਕਰਨ ਨਾਲ ਆਪਾਂ ਜਿਹੜੀ ਹੈ ਇਮਪਲੋਈਮੈਂਟ ਜਨਰੇਸ਼ਨ ਵੀ ਕਰਦੇ ਹਨ ਤੇ ਜਿਆਦਾ ਤੋਂ ਜਿਆਦਾ ਲੋਕੀ ਇੰਪਲੋਇਡ ਹੁੰਦੇ ਹਨ ਇਸ ਤੋਂ ਬਾਅਦ ਅਸੀਂ ਨਵਾਂ ਨਵਾਂ ਕਾਰੋਬਾਰ ਸ਼ੁਰੂ ਕਰਦੇ ਹਨ ਤੇ ਕਾਰੋਬਾਰ ਸ਼ੁਰੂ ਕਰਨ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਪ੍ਰੋਫਿਟ ਦੀ ਗੱਲ ਕਰਦੇ ਹਾਂ ਤੇ ਪ੍ਰੋਫਿਟ ਦੀ ਗੱਲ ਕਰਨ ਤੋਂ ਬਾਅਦ ਅਸੀਂ ਉਹਨੂੰ ਕਿਵੇਂ ਅੱਗੇ ਵਧਾਉਣਾ ਹੈ ਤੇ ਉਹਦੇ ਬਾਰੇ ਜਾਣਕਾਰੀ ਲੈਂਦੇ ਹਨ ਇਹ ਸਾਡੇ ਸੁਸਾਇਟੀ ਲਈ ਬਹੁਤ ਜਿਆਦਾ ਚੰਗਾ ਹੁੰਦਾ ਹੈ ਜ਼ਿਆਦਾ ਤੋਂ ਜ਼ਿਆਦਾ ਬਿਜ਼ਨਸ ਕਰਨ ਦੇ ਨਾਲ ਲੋਕੀ ਜਿਆਦਾ ਤੋਂ ਜਿਆਦਾ ਤਨਖਾਹ ਲੈਂਦੇ ਹਨ ਤਨਖਾਹ ਲੈਣ ਤੋਂ ਬਾਅਦ ਉਹ ਆਪਾਂ ਨੇ ਜਰੂਰਤਾਂ ਨੂੰ ਪੂਰੀਆਂ ਕਰਦੇ ਹਨ ਤੇ ਕਾਰੋਬਾਰ ਸ਼ੁਰੂ ਹੋ ਜਾਂਦਾ ਹੈ ਕਾਰੋਬਾਰ ਸ਼ੁਰੂ ਹੋਣ ਦੇ ਨਾਲ ਦੇ ਨਾਲ ਆਪਾਂ ਹੋਰ ਸਾਰਾ ਆਪਣੀਆਂ ਚੀਜ਼ਾਂ ਨੂੰ ਲੈਂਦੇ ਹਨ ਉਹ ਚੀਜ਼ਾਂ ਸਾਡੀਆਂ ਆਪਣੀਆਂ ਅਧੂਰੀਆਂ ਹੁੰਦੀਆਂ ਹਨ ਤੇ ਉਹਨੂੰ ਪੂਰਾ ਕਰਨ ਵਾਸਤੇ ਸਾਨੂੰ ਗਵਰਮੈਂਟ ਜਾਂ ਸਰਕਾਰ ਦੀ ਲੋੜ ਪੈਂਦੀ ਹੈ ਬਹੁਤ ਸਾਰੀ ਸਰਕਾਰੀ ਯੋਜਨਾ ਵੀ ਹੈਗੀ ਹੈ ਜੋ ਸਾਡੇ ਬਿਜਨਸ ਨੂੰ ਪਰਸਾਹਿਤ ਕਰਦੇ ਹਨ ਆਪਾਂ ਉਹਦੇ ਵਿੱਚ ਵੀ ਜਾ ਕੇ ਰਜਿਸਟਰ ਕਰ ਸਕਦੇ ਹਾਂ ਰਜਿਸਟਰ ਕਰਨ ਤੋਂ ਬਾਅਦ ਅਸੀਂ ਉਹਦੇ ਨਾਲ ਯੋਜਨਾਵਾਂ ਬਣਾ ਸਕਦੇ ਹਾਂ ਯੋਜਨਾਵਾਂ ਨੂੰ ਅੱਗੇ ਪ੍ਰੋਸਾਹਿਤ ਕਰ ਸਕਦੇ ਹਾਂ ਯੋਜਨਾਵਾਂ ਜਿਹੜੀਆਂ ਹੁੰਦੀਆਂ ਸਰਕਾਰ ਦੇ ਦੁਆਰਾ ਹੀ ਅਯੋਜਿਤ ਕੀਤੀ ਜਾਂਦੀ ਹਨ ਤੇ ਉਹ ਕਾਰੋਬਾਰਾਂ ਵਿੱਚ ਜੋ ਯੋਜਨਾ ਬਣਾਉਣ ਦੇ ਵਿੱਚ ਵੀ ਸਾਨੂੰ ਮਿਹਨਤ ਕਰਨੀ ਪੈਂਦੀ ਹੈ ਤੇ ਮਿਹਨਤ ਕਰਨ ਦੇ ਨਾਲ ਹੀ ਆਪਾਂ ਆਪਣੇ ਬਿਜਨਸ ਨੂੰ ਅੱਗੇ ਵਧਾ ਸਕਦੇ ਹਾਂ